ਅਸੀਂ ਸਰਕਾਰ ਦੀਆਂ ਕਈ ਸਕੀਮਾਂ ਅਤੇ ਪਹਿਲ ਕਦਮੀਆਂ ਤੋਂ ਜਾਣੂ ਹਾਂ ਸਿਹਤ ਸੰਭਾਲ ਲਾਭ ਪ੍ਰਦਾਨ ਕਰਦੀਆਂ ਨੇ ਜਿਵੇਂ ਕਿ ਸਰਕਾਰ ਨੇ ਮੁਹੱਲਾ ਕਲੀਨਿਕ ਖੋਲ੍ਹੇ ਹਨ ਇਹਨਾਂ ਕਲੀਨਿਕਾਂ ਵਿੱਚ ਮੁਫਤ ਦਵਾਈਆਂ ਮਿਲਦੀਆਂ ਹਨ ਗਰੀਬ ਲੋਕ ਵੀ ਇਸ ਦਵਾਈਆਂ ਨੂੰ ਖਰੀਦ ਸਕਦੇ ਹਾਂ ਸਰਕਾਰ ਨੇ ਸਾਰੇ ਪੰਜ ਲੱਖ ਬੀਮਾ ਦੀ ਯੋਜਨਾ ਕੀਤੀ ਹੈ ਜਿਸ ਵਿੱਚ ਸਾਨੂੰ ਕੋਈ ਭੁਗਤਾਨ ਨਹੀਂ ਕਰਨਾ ਪੈਂਦਾ ਇਸ ਵਿੱਚ ਮਰੀਜ਼ ਦਾ ਓਪਰੇਸ਼ਨ ਅਤੇ ਦਵਾਈਆਂ ਦਾ ਖਰਚਾ ਵੀ ਇਸ ਬੀਮੇ ਰਾਹੀਂ ਕੀਤਾ ਜਾਂਦਾ ਹੈ ਸਰਕਾਰ ਵੱਲੋਂ ਬੱਚਾ ਪੈਦਾ ਕਰਨ 'ਤੇ ਔਰਤ ਨੂੰ ਛੇ ਹਜ਼ਾਰ ਰੁਪਏ ਪੈਸੇ ਦਿੱਤੇ ਜਾਂਦੇ ਹਨ ਬੱਚੇ ਦੀ ਜਾਂਚ ਅਤੇ ਟੀਕਾਕਰਨ ਵੀ ਫ੍ਰੀ ਕੀਤਾ ਜਾਂਦਾ ਹੈ ਸਰਕਾਰ ਵੱਲੋਂ ਸ਼ਗਨ ਸਕੀਮ ਵੀ ਚਾਲੂ ਕੀਤੀ ਗਈ ਹੈ ਇਹਨਾਂ ਸਕੀਮਾਂ ਦਾ ਲਾਭ ਆਮ ਆਦਮੀ ਗਰੀਬ ਆਦਮੀ ਅਤੇ ਬੇਰੁਜ਼ਗਾਰ ਲੈ ਸਕਦੇ ਹਨ ਇਹਨਾਂ ਸਕੀਮਾਂ ਦੀ ਅਸੀਂ ਸੇਵਾ ਕੇਂਦਰ ਦਿੱਤੀ ਸਾਰੇ ਜਾਂਦੇ ਹਨ ਇਹਨਾਂ ਸਕੀਮਾਂ ਦੇ ਸਾਨੂੰ ਬਹੁਤ ਲਾਭ ਹਨ